ਹੈਲੋ ਮੈਂ ਤੁਹਾਡੀ ਮਦਦ ਲਈ ਫੋਨ ਕੀਤਾ ਹੈ ਮੇਰਾ ਆਧਾਰ ਕਾਰਡ ਗੁੰਮ ਗਿਆ ਹੈ ਅਤੇ ਮੈਨੂੰ ਹੁਣ ਇਸਦੀ ਇੱਕ ਡਿਜ਼ਲ ਕੋਪੀ ਚਾਹੀਦੀ ਹੈ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਹਰ ਚੀਜ਼ਾਂ ਲਈ ਆਧਾਰ ਕਾਰਡ ਦੀ ਲੋੜ ਪੈਂਦੀ ਹੈ ਜਿਵੇਂ ਕਿ ਬੈਂਕ ਸਕੂਲ ਗਵਰਨਮੈਂਟ ਕੰਮ ਸਭ ਕੁਛ ਲਈ ਹੁਣ ਜਿੱਦਾਂ ਕਿ ਮੇਰਾ ਆਧਾਰ ਕਾਰਡ ਗੁੰਮ ਗਿਆ ਹੈ ਅਤੇ ਮੈਂ ਪਰੇਸ਼ਾਨ ਹਾਂ ਪਰ ਮੈਨੂੰ ਪਤਾ ਹੈ ਕਿ ਮੈਂ ਇਸਦੀ ਡਿਜ਼ਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦਾ ਤੁਸੀਂ ਪਲੀਜ਼ ਮੇਰੀ ਮਦਦ ਕਰ ਦਿਓ ਇਹ ਪਤਾ ਲੱਗੇ ਵਿੱਚ ਕਿ ਮੈਂ ਆਪਣਾ ਆਧਾਰ ਨਵਾਂ ਨੰਬਰ ਕਿਵੇਂ ਲੱਭ ਸਕਦਾ ਹਾਂ ਜਾਂ ਡਿਜੀਟਲ ਕਾਪੀ ਡਾਊਨਲੋਡ ਕਰ ਸਕਦਾ ਹਾਂ ਸ਼ਾਇਦ ਕੋਈ ਆਨਲਾਈਨ ਤਰੀਕਾ ਹੋਵੇ ਜਾਂ ਤੁਸੀਂ ਜਾਣਦੇ ਹੋਵੋਗੇ ਕਿ ਕਿੱਦਾਂ ਇਹ ਹੋ ਸਕਦਾ ਪਲੀਜ ਦੱਸੋ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਮੈਨੂੰ ਜਲਦੀ ਹੈ ਕਿਉਂਕਿ ਇਹ ਕਾਰਡ ਕੱਲ੍ਹ ਹੀ ਚਾਹੀਦਾ ਹੈ